ਅੱਜ ਕੱਲ੍ਹ ਭਾਰਤ ਵਿੱਚ ਬੜੀਆਂ ਹੀ ਔਨਲਾਈਨ ਵੈਬਸਾਈਟਸ ਹਨ ਜਿਵੇਂ ਕਿ ਸਵੀਗੀ ਜੂਮੈਟੋ ਹੋਰ ਬਹੁਤ ਸਾਰੀਆਂ ਅਸੀਂ ਇਹਨਾਂ ਤੋਂ ਆਰਡਰ ਮੰਗਵਾ ਸਕਦੇ ਹਾਂ ਜਿਵੇਂ ਕਿ ਬਰਗਰ ਨਿਊਡਲ ਪੀਜ਼ਾ ਟਿੱਕੀ ਗੋਲ ਗੱਪੇ ਆਦਿ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮੰਗਵਾ ਸਕਦੇ ਹਾਂ ਜਿਵੇਂ ਕਿ ਅਸੀਂ ਕੱਲ੍ਹ ਤੁਹਾਡੇ ਰੈਸਟੋਰੈਂਟ ਤੋਂ ਖਾਣਾ ਮੰਗਵਾਇਆ ਜੋ ਕਿ ਆਪਾਂ ਸਵਿਗੀ ਦੁਆਰਾ ਮੰਗਵਾਇਆ ਸੀ ਸਾਡਾ ਔਡਰ ਨੰਬਰ ਪੱਚੀ ਇਕੱਤੀ ਦੋ ਸੀ ਅਸੀਂ ਖਾਣ ਲਈ ਜੋ ਰੋਟੀ ਅਤੇ ਹੋਰ ਵੀ ਚੀਜ਼ਾਂ ਮੰਗਵਾਈਆਂ ਸੀ ਉਹ ਬਹੁਤ ਹੀ ਬੇਕਾਰ ਸਨ ਜਦੋਂ ਅਸੀਂ ਖਾਣ ਲੱਗੇ ਤਾਂ ਸਾਨੂੰ ਬਿਲਕੁਲ ਵੀ ਇਸ ਦਾ ਖਾਣ ਦਾ ਟੇਸਟ ਨਾ ਹੀ ਆਇਆ ਨਾ ਹੀ ਇਸ ਵਿੱਚ ਨਕ ਨਮਕ ਵਗੈਰਾ ਠੀਕ ਸੀ ਅਤੇ ਨਾ ਹੀ ਇਹ ਚੱਜ ਤਰ੍ਹਾਂ ਬਣਾਈ ਹੋਈ ਸੀ ਮੈਂ ਇਸ ਦੀ ਸ਼ਿਕਾਇਤ ਕੀਤੀ ਪਰ ਮੇਰੀ ਕਿਸੇ ਨੇ ਨਹੀਂ ਸੁਣੀ ਜਿਸ ਕਰਕੇ ਮੈਂ ਤੁਹਾਨੂੰ ਇਹ ਨੈਗਟਿਵ ਫੀਡਬੈਕ ਦੇ ਰਹੀ ਹਾਂ ਜਾਂ ਤੁਸੀਂ ਮੇਰਾ ਰਿਫੰਡ ਵਾਪਸ ਦੇ ਦਿਓ ਅਤੇ ਜਾਂ ਮੈਨੂੰ ਇਸ ਤਾ ਇਸ ਦੁਆਰਾ ਬਿਨਾਂ ਪੈਸਾ ਲਿਤੇ ਮੇਰਾ ਔਡਰ ਦੁਬਾਰਾ ਤੋਂ ਭੇਜ ਦਿਓ